ਹੈਲੋ ਹਾਂਜੀ ਹਾਂਜੀ ਮੈਡਮ ਬਸ ਵਧੀਆ ਠੀਕ ਠਾਕ ਗੁਰਮੀਤ ਮੈਡਮ ਤੁਸੀਂ ਦੱਸੋ ਤੁਸੀਂ ਕੀ ਕਰਦੇ ਹਾਂਜੀ ਸਕੂਲ ਮੇਰਾ ਠੀਕ ਚੱਲ ਰਿਹਾ ਹੈ ਬਸ ਥੋੜ੍ਹਾ ਜਿਹਾ ਆਉਣ ਜਾਣ ਦੇ ਵਿੱਚ ਅੱਜ ਕੱਲ੍ਹ ਔਖਾ ਹੋ ਜਾਂਦਾ ਬਹੁਤ ਜ਼ਿਆਦਾ ਟਰੈਫਿਕ ਹੋ ਗਈ ਹਾਂਜੀ ਹਾਂ ਬਹੁਤ ਟਰੈਫਿਕ ਹੋ ਚੁੱਕੀ ਹੈ ਇਹਦੇ ਵਿੱਚ ਇਹ ਹੈ ਕਿ ਹੁਣ ਜਿਵੇਂ ਪਹਿਲਾਂ ਤਾਂ ਹੈ ਨਾ ਸਕੂਟਰ ਅਤੇ ਮੋਟਰਸਾਈਕਲ ਵਗੈਰਾ ਹੀ ਹੁੰਦੇ ਸੀਗੇ ਹੁਣ ਮੈਨੂੰ ਲੱਗਦਾ ਹਰੇਕ ਘਰ ਦੇ ਵਿਚ ਕਾਰ ਆ ਗਈ ਕਾਰਾਂ ਦੇ ਹੋਣ ਦੇ ਕਰਕੇ ਹਾਂ ਹਾਂ ਹਰੇਕ ਘਰ 'ਚ ਦੇਖੀਏ ਦੋ ਦੋ ਤਿੰਨ ਤਿੰਨ ਕਾਰਾਂ ਨੇ ਜਿਹੜਾ ਜਿਹੜਾ ਵੀ ਹੈਗਾ ਹੈ ਨਾ ਸਭ ਨੇ ਆਪਣੀਆਂ ਆਪਣੀਆਂ ਰੱਖੀਆਂ ਹੋਈਆਂ ਨੇ ਫਿਰ ਵਹੀਕਲ ਜਿਹੜੇ ਦੂਸਰੇ ਨੇ ਸਕੂਟਰ ਮੋਟਰਸਾਈਕਲ ਉਹ ਵੀ ਜਿਹੜੇ ਨੇ ਉਹ ਬਹੁਤ ਨੇ ਬੱਚਿਆਂ ਲਈ ਵੀ ਔਖਾ ਹੋ ਗਿਆ ਸੜਕ ਦੇ ਉੱਤੇ ਹੈ ਨਾ ਜਾਣਾ ਆਉਣਾ ਜਿਵੇਂ ਬੱਚਿਆਂ ਨੂੰ ਡਰ ਲੱਗਦਾ ਕਿ ਹੁਣ ਬੱਚਿਆਂ ਨੂੰ ਕਿਵੇਂ ਭੇਜੀਏ ਇੰਨੀ ਟਰੈਫਿਕ ਦੇ ਵਿੱਚ ਹਾਂਜੀ ਹਾਂ ਸੜਕਾਂ ਥੋੜ੍ਹੀਆਂ ਖੁੱਲ੍ਹੀਆਂ ਹੋਣ

ਇਹ ਤਾਂ ਹੈਗਾ ਏ ਅਤੇ ਨਾਲੇ ਇਹ ਨਾ ਕਿ ਜੇ ਹੁਣ ਦੇਖੋ ਸੜਕਾਂ ਥੋੜ੍ਹੀਆਂ ਖੁੱਲ੍ਹੀਆਂ ਹੋ ਜਾਣ ਤਾਂ ਵੀ ਥੋੜ੍ਹਾ ਠੀਕ ਹੋ ਜੇ ਥੋੜ੍ਹੇ ਰੂਲ ਜਿਹੜੇ ਰੈਗੂਲੇਸ਼ਨ ਨੇ ਉਹ ਬਣ ਜਾਣ ਜਿਹੜੀਆਂ ਲਾਈਟਸ ਆ ਹੈ ਨਾ ਲਾਈਟਸ ਜਿਹੜੀਆਂ ਨੇ ਸਾਰੀਆਂ ਸਾਰੇ ਚੌਂਕਾਂ ਦੇ ਵਿੱਚ ਜੇ ਲਾਈਟਾਂ ਪ੍ਰੋਪਰ ਹੋ ਜਾਣ ਕਿਉਂਕਿ ਆਪਣੇ ਤਾਂ ਇੱਥੇ ਇੱਕ ਦੋ ਚੌਕਾਂ ਦੇ ਵਿੱਚ ਹੀ ਲਾਈਟਾਂ ਨੇ ਸਾਰੀਆਂ ਥਾਵਾਂ 'ਤੇ ਤਾਂ ਹੈਗੀਆਂ ਨਹੀਂ ਆ ਹਾਂ ਸੜਕ ਕ੍ਰੋਸ ਕਰਨੀ ਤਾਂ ਬਹੁਤ ਹੀ ਔਖੀ ਹੋ ਰਹੀ ਆ ਇੱਕ ਉੱਥੇ ਵਿੱਚ ਜਿਵੇਂ ਜਾਨਵਰ ਵਗੈਰਾ ਕਈ ਵਾਰੀ ਤੁਰੇ ਫਿਰਦੇ ਆ ਹੈ ਨਾ ਕੋਈ ਕੁੱਤੇ ਵਗੈਰਾ ਜਾਂ ਗਾਵਾਂ ਜਾਂ ਉਹ ਵੀ ਔਖਾ ਹੋ ਜਾਂਦਾ ਹਾਂ ਟਰੈਫਿਕ ਦੇ ਨਾਲ ਦੇਖੋ ਪੋਲਿਊਸ਼ਨ ਵੀ ਹੋ ਰਿਹਾ ਨਾ ਜਿਹੜਾ ਧੂੰਆ ਵਗੈਰਾ ਜਾਂ ਕਈ ਕਈ ਲੋਕੀ ਨਾ ਤਾਂ ਜਿਵੇਂ ਉਹ ਗੱਡੀਆਂ ਵਗੈਰਾ ਦੇ ਵਿੱਚੋਂ ਧੂੰਆ ਵਗੈਰਾ ਵੀ ਨਿਕਲ ਰਿਹਾ ਹੁੰਦਾ ਅਤੇ ਖਰਚੇ ਵੀ ਇਹਦੇ ਨਾਲ ਦੇਖੋ ਵੱਧ ਰਹੇ ਹੈਗਾ ਤਾਂ ਔਖਾ ਹੀ ਆ ਹਰ ਚੀਜ਼ ਦਾ ਪੈਟਰੋਲ ਡੀਜ਼ਲ ਮਹਿੰਗੇ ਹਾਂ ਇਹ ਤਾਂ ਹੈ ਜਦੋਂ ਤੱਕ ਜਿਹੜਾ ਹੈ ਪ੍ਰਸ਼ਾਸਨ ਕੁਛ ਨਹੀਂ ਕਰਦਾ ਉਦੋਂ ਤੱਕ ਤਾਂ ਐਡਮਨੀਸਟ੍ਰੇਸ਼ਨ ਤੋਂ ਬਿਨਾਂ ਤਾਂ ਸਾਰਾ ਕੁਛ ਜਿਹੜਾ ਔਖਾ ਹੀ ਹੈ ਹਾਂ ਹਾਂ ਥੋੜ੍ਹਾ ਫਾਈਨ ਜਿਵੇਂ ਫੋਰਨ ਕੰਟਰੀਜ਼ ਵਿੱਚ ਆ ਨਾ ਜਾਂ ਆਪਣੇ ਹੋਰ ਵਧੀਆ ਸਿਟੀ ਜਿਹੜੇ ਦੂਏ ਦੂਜੇ ਸਿਟੀਜ ਆ ਉਹਨਾਂ ਦੇ ਵਿੱਚ ਹੈਗਾ ਫਾਈਨ ਵਗੈਰਾ ਜਿਹੜੇ ਲੱਗੇ ਨੇ ਉਹ ਲਾ ਦੇਣ ਤਾਂ ਠੀਕ ਹੈ ਹਾਂ ਇਹ ਤਾਂ ਹੈ ਹੀ ਹੈ ਚਲੋ ਕੋਈ ਗੱਲ ਨਹੀਂ ਦੇ ਦੇਖੀ ਜਾਂਦੇ ਹਾਂਜੀ ਹਾਂ ਜ਼ਰੂਰ ਓਕੇ ਹੈ ਨਾ ਓਕੇ ਬਾਏ ਸਤਿ ਸ਼੍ਰੀ ਅਕਾਲ